ਪੰਜਾਬ ਦੀ ਸੜਕਾਂ ਸਮੇਂ ਦੇ ਨਾਲ ਠੀਕ ਹੁੰਦੀ ਗਈਆਂ ਨੇ ਜਿੱਦਾਂ ਜਿੱਦਾਂ ਸ਼ਹਿਰਾਂ ਵਿੱਚ ਵਿਕਾਸ ਹੋਇਆ ਹੈ ਉੱਦਾਂ ਹੀ ਸੜਕਾਂ ਵੀ ਵੱਧਦੀਆਂ ਗਈਆਂ ਨੇ ਸੜਕਾਂ ਪਹਿਲਾਂ ਜਿਹੜੀ ਦੋ ਲੇਨ ਦੀ ਹੁੰਦੀਆਂ ਸੀਗੀਆਂ ਹੁਣ ਚਾਰ ਲੇਨ ਛੇ ਲੇਨ ਬਣ ਗਈਆਂ ਨੇ ਫਲਾਈਓਵਰ ਤਾਂ ਇੱਕ ਆਮ ਗੱਲ ਹੋ ਗਈ ਹੈ ਜਿੰਨੇ ਵੱਡੇ ਸ਼ਹਿਰ ਹੈ ਕਿ ਜਿੱਦਾਂ ਸਾਡਾ ਲੁਧਿਆਣਾ ਜਲੰਧਰ ਅੰਮ੍ਰਿਤਸਰ ਇੱਥੇ ਫਲਾਈਓਵਰ ਦਾ ਜਾਲ ਪੈ ਗਿਆ ਪਰ ਇਹਦੇ ਨਾਲ ਹੀ ਜਿਹੜੀ ਪਿੰਡ ਦੀ ਸੜਕਾਂ ਹੈਗੀਆਂ ਉਹਨਾਂ ਦੇ ਹਾਲ ਬੜੇ ਮਾੜੇ ਹੈਗੇ ਹੈ ਉਹਨਾਂ ਵਿੱਚ ਮੈਂਟੀਨੇਂਸ ਲਈ ਫੰਡ ਨਹੀਂ ਆ ਰਹੇ ਹੈਗੇ ਜਿਸ ਕਰਕੇ ਉਹਦਾ ਸੁਧਾਰ ਨਹੀਂ ਕੀਤਾ ਜਾ ਪਾ ਰਿਹਾ ਸੜਕਾਂ ਅਤੇ ਪੁੱਲ ਸਾਡੇ ਆਉਣ ਜਾਣ ਵਾਸਤੇ ਬਹੁਤ ਹੀ ਜ਼ਰੂਰੀ ਹੈਗੇ ਕਿਉਂਕਿ ਪੰਜਾਬ ਵਿੱਚ ਜ਼ਿਆਦਾਤਰ ਬੱਸ ਅਤੇ ਗੱਡੀਆਂ ਦਾ ਹੀ ਇਸਤੇਮਾਲ ਹੁੰਦਾ ਹੈ